ਸਾਡੇ ਨੇੜਲੇ ਸਥਾਨ ਧਾਰਮਿਕ ਸਥਾਨ ਕਿਲ੍ਹਾ ਸਾਹਿਬ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਆ ਜਿੱਥੇ ਸਾਨੂੰ ਮੈਨੂੰ ਜਾ ਕੇ ਬੜਾ ਹੀ ਸਕੂਨ ਮਿਲਦਾ ਹੈ ਆਨੰਦ ਆਉਂਦਾ ਹੈ ਅਤੇ ਸਤਿਸੰਗ ਸੁਣਦੇ ਹਾਂ ਸ਼ਬਦ ਸੁਣਦੇ ਹਾਂ ਗੁਰੂ ਦੀ ਬਾਣੀ ਸੁਣਦੇ ਹਾਂ ਉੱਥੇ ਕਾਫੀ ਸੁੱਖਾਂ ਪੂਰੀਆਂ ਹੁੰਦੀਆਂ ਰੈਗੂਲਰ ਡੇਲੀ ਜਾਣ ਨਾਲ ਲਗਾਤਾਰ ਚਾਲੀ ਦਿਨ ਜਾ ਕੇ ਲਗਾਤਾਰ ਚਾਲੀ ਦਿਨ ਨੂੰ ਜਾ ਕੇ ਉੱਥੇ ਮੱਥਾ ਟੇਕ ਕੇ ਤਾਂ ਸੁੱਖਾਂ ਪੂਰੀਆਂ ਹੁੰਦੀਆਂ ਹੈਗੀਆਂ ਬਹੁਤ ਲੋਕਾਂ ਦੀ ਮਾਨਤਾ ਉੱਥੇ ਤਕਰੀਬਨ ਲੋਕ ਸਾਰੇ ਸ਼ਹਿਰ ਸ਼ਹਿਰਾਂ ਦੇ ਲੋਕ ਉੱਥੇ ਜਾਂਦੇ ਆ ਮੱਥਾ ਟੇਕਦੇ ਆ ਪਾ ਪਾਠ ਕਰਦੇ ਆ ਜਪੁਜੀ ਸਾਹਿਬ ਦਾ ਪਾਠ ਕਰਦੇ ਆ ਅਤੇ ਬਾਣੀ ਸੁਣਦੇ ਆ ਸਾਨੂੰ ਬੜਾ ਆਨੰਦ ਆਉਂਦਾ ਉੱਥੇ ਜਾ ਕੇ ਜਿੰਨੀ ਵੀ ਥਕਾਵਟ ਔਰ ਟੈਂਸ਼ਨ ਹੁੰਦੀ ਮਨ ਤੋਂ ਲਹਿ ਜਾਂਦੀ ਆ ਅਤੇ ਬੜੀ ਮਹੱਤਤਾ ਕਿਲ੍ਹਾ ਸਾਹਿਬ ਦੀ ਬੜੀ ਮਹੱਤਤਾ ਗੁਰੂ ਘਰ ਬਣਿਆ ਹੋਇਆ ਹੈਗਾ ਉੱਥੇ ਜਾ ਕੇ ਦੂਰੋਂ ਆਈਆਂ ਸੰਗਤਾਂ ਨੂੰ ਲੰਗਰ ਛਕਦੇ ਆ ਅਤੇ ਵਿਸਾਖੀ ਵਗੈਰਾ ਨੂੰ ਕਾਫੀ ਉੱਥੇ ਜ਼ਿਆਦਾ ਭੀੜ ਹੁੰਦੀ ਆ ਕਾਫੀ ਸੰਗਤਾਂ ਆਉਂਦੀਆਂ ਦਿਨ ਤਿਓਹਾਰ 'ਤੇ ਗੁਰਪੁਰਬ 'ਤੇ ਸਾਨੂੰ ਬੜਾ ਆਨੰਦ ਮਹਿਸੂਸ ਹੁੰਦਾ ਉੱਥੇ